ਹੈਲੋ ਹਾਂਜੀ ਪੁੱਤਰ ਪਹੁੰਚ ਗਏ ਹਾਂਜੀ ਪੁੱਜ ਗਏ ਹੋਸਟ ਉਹ ਹੋਸਟਲ ਅੱਛਾ ਠੀਕ ਠਾਕ ਹੈ ਅੱਛਾ ਕਿੰਨੇ ਕਲਾਸਮੇਟ ਆ ਤੁਹਾਡੇ ਉੱਥੇ ਅੱਛਾ

ਅੱਛਾ ਹੋਰ ਰੋਟੀ ਪਾਣੀ ਦਾ ਠੀਕ ਆ ਬਹੁਤ ਵਧੀਆ ਪੱਖੇ ਪੁਖੇ ਠੀਕ ਹੈ ਲੱਗ ਪੱਖੇ ਵਗੈਰਾ ਏ ਸੀ ਵੀ ਲੱਗਿਆ ਉੱਥੇ ਫਿਰ ਤਾਂ ਵਧੀਆ

ਅੱਛਾ ਅੱਛਾ ਫਿਰ ਤਾਂ ਠੀਕ ਆ ਫਿਰ ਤਾਂ ਵਧੀਆ ਚਲੋ ਫਿਰ ਕਰੋ ਇੰਜੋਏ ਠੀਕ ਹੈ ਠੀਕ